ਪੰਜਾਬ ਵਿੱਚ ਖੇਡ ਖੇਤਰ ਖੇਡਾਂ ਨਾਲ ਸੰਬੰਧਿਤ ਅਸਮਰੱਥਾਵਾਂ ਅਤੇ ਜਾਂ ਕਮਜ਼ੋਰੀਆਂ ਦੇ ਮੁੱਦਿਆਂ ਨੂੰ ਅਸੀਂ ਕਈ ਢੰਗਾਂ ਨਾਲ ਹੱਲ ਕਰ ਸਕਦੇ ਹਾਂ ਜਿਵੇਂ ਕਿ ਕੁਝ ਸਹੂਲਤਾਂ ਹੇਠ ਲਿਖੀਆ ਹੋਈਆ ਹਨ ਪਹੁੰਚਯੋਗ ਸਹੂਲਤਾਂ ਲਾਕਰ ਰੂਮ ਤੋਂ ਲੈ ਕੇ ਦਰਸ਼ਨ ਜੋਨਾਂ ਤੱਕ ਖੇਡ ਸਹੂਲਤਾਂ ਦੇ ਸਾਰੇ ਖੇਤਰਾਂ ਤੱਕ ਪਹੁੰਚਯੋਗ ਹੋਣਾ ਚਾਹੀਦਾ ਹੈ ਫਿਰ ਵੀ ਕੁਝ ਖੇਡ ਸਥਾਨਾਂ ਵਿੱਚ ਲੋੜੀਂਦੀ ਰਿਸ਼ ਰਿਹਾਇਸ਼ਾ ਦੀ ਘਾਟ ਹੈ ਗਤੀਸ਼ੀਲਤਾ ਵਿੱਚ ਕਮੀ ਵਾਲੇ ਅਥਲੀਟਾਂ ਅਤੇ ਸਮਰਥਕਾਂ ਲਈ ਰੁਕਾਵਟ ਪੈਦਾ ਕਰਦੇ ਹਨ ਸਾਜ ਸਮਾਜ ਦੀਆਂ ਸੀਮਾਵਾਂ ਪ੍ਰੰਪਰਾਗਤ ਸਪੋਰਟਸ ਕੀ ਹਮੇਸ਼ਾ ਵਿਭਿਨ ਲੋੜਾਂ ਦੇ ਅਨੁਕੂਲ ਨਹੀਂ ਹੁੰਦੇ ਹਨ ਉਦਾਹਰਣ ਲਈ ਸਾਜ ਸਮਾਨ ਦੇ ਟੁਕੜਿਆਂ ਵਿਚਕਾਰ ਜਿੱਥੇ ਵਹੀਲਚੇਅਰ ਲਈ ਚਾਲ ਚੱਲਣ ਨੂੰ ਸੀਮਿਤ ਕਰ ਸਕਦੀ ਹੈ ਜਦੋਂ ਕਿ ਚਮਕਦਾਰ ਚਮਕਦਾਰ ਰੰਗ ਜਾਂ ਦ੍ਰਿਸ਼ਟੀਗਤ ਦੇ ਤੌਰ 'ਤੇ ਗੁੰਝਲਦਾਰ ਉਪਕਰਣ ਸਮੇਂ ਦੀ ਪ੍ਰਕਿਰਿਆ ਵਿਕਾਰ ਵਾਲੇ ਵਿਅਕਤੀਆਂ ਲਈ ਬਹੁਤ ਜ਼ਿਆਦਾ ਹੋ ਸਕਦੀਆਂ ਹਨ ਆਵਾਜਾਈ ਦੀਆਂ ਰੁਕਾਵਟਾਂ ਆਵਾਜਾਈ ਖੇਡਾਂ ਦੇ ਸਮਾਗਮਾਂ ਤੱਕ ਅਤੇ ਉਹਨਾਂ ਤੋਂ ਆਰਾਮ ਨਾਲ ਇਹ ਯਾਤਰਾ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੀ ਹੈ ਖੇਡ ਸਥਾਨਾਂ ਦੇ ਅੰਦਰ ਯਾਤਰਾ ਕਰਨਾ ਵੀ ਸਮੱਸਿਆ ਵਾਲਾ ਹੋ ਸਕਦਾ ਹੈ ਜਿਵੇਂ ਕਿ ਪਾਰਕਿੰਗ ਤੋਂ ਬੈਠਣ ਵਾਲੇ ਖੇਤਰਾਂ ਤੱਕ ਜਾਣਾ ਉਦਾਰਣ ਲਈ